ਮੈਂ ਆਪਣਾ ਜੋ ਤਜਰਬਾ ਹੈ ਉਹ ਜਵੈਲਰੀ ਦੇ ਬਾਰੇ ਸ਼ੇਅਰ ਕਰਨਾ ਚਾਹਾਂਗੀ ਇੱਕ ਵਾਰੀ ਮੈਂ ਈਅਰਿੰਗ ਔਡਰ ਕੀਤੇ ਸੀਗੇ ਫਲਿੱਪਕਾਟ ਤੋਂ ਮੈਂ ਔਨਲਾਈਨ ਈਅਰਿੰਗ ਦੇਖੇ ਅਤੇ ਮੈਨੂੰ ਬਹੁਤ ਵਧੀਆ ਵਧੀਆ ਈਅਰਿੰਗ ਦਿਖ ਰ ਉਸ ਵਿੱਚ ਨਜ਼ਰ ਆਏ ਤਾਂ ਮੈਂ ਇੱਕ ਜਿਹੜਾ ਪੇਅਰ ਸੀ ਉਹ ਔਡਰ ਕਰਤਾ ਤਾਂ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਜਦੋਂ ਉਹ ਪ੍ਰੋਡਕਟ ਮੇਰੇ ਘਰ ਆਇਆ ਤਾਂ ਮੈਂ ਉਹਨੂੰ ਓਪਨ ਕਰਕੇ ਦੇਖਿਆ ਤਾਂ ਜਿਹੜਾ ਮੈਂ ਔਨਲਾਈਨ ਦੇ ਵਿੱਚ ਔਡਰ ਕੀਤਾ ਸੀ ਤਾਂ ਉਹ ਉਸ ਵਰਗਾ ਨਹੀਂ ਸੀ ਬਿਲਕੁਲ ਹੋਰ ਹੀ ਕੁਛ ਉਹਨਾਂ ਨੇ ਮੈਨੂੰ ਭੇਜਤਾ ਤਾਂ ਇਸ ਤੋਂ ਬਾਅਦ ਵੀ ਇਹ ਸੀਗਾ ਕਿ ਜਦੋਂ ਮੈਂ ਉਹਨਾਂ ਨੂੰ ਆਪਣੇ ਈਅਰ ਦੇ ਵਿੱਚ ਪਾਇਆ ਤਾਂ ਇਕਦਮ ਉਹ ਟੁੱਟ ਹੀ ਗਏ ਤਾਂ ਮੇਰਾ ਐਕਸਪੀਰੀਅੰਸ ਹੈ ਜਿਹੜਾ ਇਹਦੇ ਬਾਰੇ ਵਧੀਆ ਨਹੀਂ ਰਿਹਾ ਮੈਨੂੰ ਲੱਗਿਆ ਕਿ ਜਿਹੜੀਆਂ ਔਨਲਾਈਨ ਚੀਜ਼ਾਂ ਅਸੀਂ ਇਸ ਤਰ੍ਹਾਂ ਮੰਗਵਾ ਲੈਂਦੇ ਹਾਂ ਆਂ ਕਿਤੋਂ ਵੀ ਤਾਂ ਉਹ ਉਹ ਬਿਲਕੁਲ ਉਸ ਤਰ੍ਹਾਂ ਨਹੀਂ ਹੁੰਦੀਆਂ ਜਿਸ ਤਰ੍ਹਾਂ ਉਹ ਸਾਨੂੰ ਨਜ਼ਰ ਆਉਂਦੀਆਂ ਨੇ ਸਾਨੂੰ ਦਿਖਾਇਆ ਕੁਛ ਹੋਰ ਜਾਂਦਾ ਪਰ ਕਈ ਵਾਰ ਸਾਨੂੰ ਭੇਜਿਆ ਕੁਛ ਹੋਰ ਜਾਂਦਾ ਤਾਂ ਇਹ ਐਕਸਪੀਰੀਅੰਸ ਹੈ ਜਿਹੜਾ ਮੇਰਾ ਬਿਲਕੁਲ ਹੀ ਬਿਲਕੁਲ ਹੀ ਵਧੀਆ ਨਹੀਂ ਰਿਹਾ